ਜਿਸ ਰਾਜ ਵਿੱਚ ਅਸੀਂ ਰਹਿੰਦੇ ਹਾਂ ਉਸ ਰਾਜ ਦੇ ਵਿੱਚ ਪੰਜਾਬ 'ਚ ਦੀਵਾਲੀ ਵੀ ਮਨਾਈ ਜਾਂਦੀ ਹੈ ਵਿਸਾਖੀ ਵੀ ਮਨਾਈ ਜਾਂਦੀ ਹੈ ਗੁਰਪੂਰਬ ਵੀ ਮਨਾਇਆ ਜਾਂਦਾ ਲੋਹੜੀ ਵੀ ਮਨਾਈ ਜਾਂਦੀ ਹੈ ਗੁਰੂਆਂ ਦੇ ਜਨਮ ਬਾਰੇ ਵੀ ਮਨਾਇਆ ਜਾਂਦਾ ਉਹਨਾਂ 'ਤੇ ਰੱਖੜੀ ਵੀ ਮਨਾਈ ਜਾਂਦੀ ਹੈ ਸਾਡੇ ਸਾਵਣ 'ਚ ਸਾਡੇ ਸਾਉਣ ਦੀ ਤੀਜ ਨੂੰ ਵੀ ਮਨਾਇਆ ਜਾਂਦਾ ਉਦੋਂ ਮਹਿੰਦੀ ਲਾਉਂਦੀਆਂ ਕੁੜੀਆਂ ਤੀਆਂ ਲਾਉਂਦੀਆਂ ਗਿੱਧਾ ਪਾਉਂਦੀਆਂ ਹੈਗੀਆਂ ਅਤੇ ਇਸ ਤੋਂ ਇਲਾਵਾ ਜਿਸ ਰਾਜ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਦੀਵਾਲੀ ਮਨਾਈ ਜਾਂਦੀ ਹੈ ਦੀਵਾਲੀ ਇਸ ਕਰਕੇ ਮਨਾਈ ਜਾਂਦੀ ਹੈ ਕਿ ਦੀਵਾਲੀ ਵਾਲੇ ਦਿਨ ਸ਼੍ਰੀ ਗੁਰੂ ਛੇਵੇਂ ਪਾਤਸ਼ਾਹ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ ਬਵੰਜਾ ਸਿੱਖਾਂ ਨੂੰ ਰਿਹਾਅ ਕਰਵਾਇਆ ਸੀਗਾ ਸ਼੍ਰੀ ਹਰਗੋਬਿੰਦ ਸਿੰਘ ਜੀ ਨੇ ਅਤੇ ਉਹ ਉਹਨਾਂ ਦੀ ਖੁਸ਼ੀ 'ਚ ਸਿੱਖਾਂ ਨੇ ਦੀਵੇ ਬਾਲੇ ਸੀ ਦੀਵਾਲੀ ਦਾ ਤਿਉਹਾਰ ਮਨਾਇਆ ਸੀ ਜਿਸ ਤੋਂ ਉਹਨੂੰ ਦੀਵਾਲੀ ਕਹਿਣ ਲੱਗ ਗਏ ਵੈਸਾਖ ਦੇ ਮਹੀਨੇ 'ਚ ਵਿਸਾਖੀ ਦਾ ਤਿਉਹਾਰ ਹੈ ਜਿਹੜਾ ਇਹ ਸਾਡੇ ਮਨਾਇਆ ਜਾਂਦਾ ਹੈਗਾ ਇਲਾਕੇ 'ਚ ਅਤੇ ਇਹ ਇਸ ਕਰਕੇ ਮਨਾਇਆ ਜਾਂਦਾ ਕਿ ਇਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀਗਾ ਪੰਜ ਪਿਆਰਿਆਂ ਨੂੰ ਅਤੇ ਉਹਨਾਂ ਨੇ ਆਪਣੀ ਇੱਕ ਖਾਲਸੇ ਦੀ ਵੱਖਰੀ ਪਹਿਚਾਣ ਬਣਾਈ ਸੀ ਉਹਨਾਂ ਨੂੰ ਪੰਜ ਕਕਾਰ ਦੇ ਕੇ ਅਤੇ ਆਪਣੀ ਸਿੱਖ ਨੂੰ ਦੂਜੇ ਧਰਮਾਂ ਨਾਲੋਂ ਵੱਖਰਾ ਕੀਤਾ ਸੀਗਾ

ਪੂਰਨਮਾਸ਼ੀ ਦੇ ਸਾਰੇ ਪੂਰਨਮਾਸ਼ੀ ਵੀ ਮਨਾਈ ਜਾਂਦੀ ਹੈਗੀ ਅੱਡੋ ਅੱਡ ਸੱਭਿਆਚਾਰ ਨਾਲ ਅੱਡੋ ਅੱਡ ਤਿਉਹਾਰ ਹਨ ਅਤੇ ਲੋਹੜੀ ਵੀ ਮਨਾਈ ਜਾਂਦੀ ਹੈ ਸਾਡੇ ਨਵੇਂ ਸਾਲ ਦੇ ਆਉਣ 'ਤੇ ਨਵੇਂ ਸਾਲ ਦੀ ਵੀ ਤਿਆਰੀ ਕੀਤੀ ਜਾਂਦੀ ਹੈ ਜਦੋਂ ਨਵਾਂ ਸਾਲ ਆਉਂਦਾ ਹੁੰਦਾ ਅਤੇ ਨਵ ਪਿਛਲੇ ਸਾਲ ਜਾਣ 'ਤੇ ਵੀ ਖੁਸ਼ੀ ਨਾਲ ਹੀ ਉਹਨੂੰ ਵਿਦਾ ਕੀਤਾ ਜਾਂਦਾ ਹੈਗਾ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਤਿਉਹਾਰ ਨੇ ਜੋ ਸਾਡੀ ਟਾਈਮ 'ਚ ਮਨਾਈ ਜਾਂਦੇ ਸਾਡੇ ਏਰੀਏ ਵਿੱਚ